ਪੰਜਾਬ ਵਿੱਚ ਵਪਾਰਕ ਖੇਤਰ ਕਈ ਤਰ੍ਹਾਂ ਦੀਆਂ ਅਨੁਕੂਲ ਰਣਨੀਤੀਆਂ ਅਤੇ ਨਵੀਨਤਾਵਾਂ ਰਾਹੀ ਵੱਖ ਵੱਖ ਚੁਣੌਤੀਆਂ ਅਤੇ ਰੁਕਾਵਟਾਂ ਦਾ ਸਰਗਰਮੀ ਨਾਲ ਜਵਾਬ ਦੇ ਰਿਹਾ ਹੈ ਡਿਜੀਟਲ ਗੋਦ ਲੈਣਾ ਮੁੱਖ ਖੇਤਰਾਂ ਵਿੱਚੋਂ ਇੱਕ ਹੈ ਜਿੱਥੇ ਕਾਰੋਬਾਰ ਮਹੱਤਵਪੂਰਨ ਤਰੱਕੀ ਕਰ ਰਹੇ ਹਨ ਆਧੁਨਿਕ ਵਣਜ ਵਿੱਚ ਟੈਕਨੋਲਜੀ ਦੀ ਮਹੱਤਤਾ ਨੂੰ ਪਹਿਚਾਣਦੇ ਹੋਏ ਬਹੁਤ ਸਾਰੀਆਂ ਕੰਪਨੀਆਂ ਸੰਚਾਲਨ ਨੂੰ ਸੁਚਾਰੂ ਬਣਾਉਣ ਗੈਹਕਾਂ ਗਾਹਕਾਂ ਦੇ ਸ਼ਮੂਲੀਅਤ ਨੂੰ ਵਧਾਉਣ ਅਤੇ ਸਮੁੱਚੀ ਕੁਸ਼ਲਤਾ ਨੂੰ ਵਧਾਉਣ ਲਈ ਡਿਜਿਟਲ ਸਾਧਨਾ ਅਤੇ ਪਲੇਟਫਾਰਮ ਵਿੱਚ ਨਿਵੇਸ਼ ਕਰ ਰਹੀਆਂ ਹਨ ਇਸ ਵਿੱਚ ਵਿਆਪਕ ਦਰਸ਼ਕਾਂ ਤੱਕ ਪਹੁੰਚਣ ਅਤੇ ਤੇਜ਼ੀ ਨਾਲ ਵਿਕਸਿਤ ਹੋ ਰਹੇ ਬਾਜ਼ਾਰ ਵਿੱਚ ਪ੍ਰਤੀਯੋਗੀ ਬਣੇ ਰਹਿਣ ਲਈ ਈਕਮਸ ਹਲ ਡਿਜੀਟਲ ਭੁਗਤਾਨ ਪ੍ਰਣਾਲੀਆਂ ਅਤੇ ਆਨ ਆਨਲਾਈਨ ਮਾਰਕੀਟਿੰਗ ਰਣਨੀਤੀਆਂ ਅਪਣਾਉਣਾ ਸ਼ਾਮਿਲ ਹੈ ਡਾਟਾ ਵਿਸ਼ਲੇਸ਼ਣ ਇੱਕ ਹੋਰ ਨਾਜੁਕ ਖੇਤਰ ਹੈ ਜਿੱਥੇ ਪੰਜਾਬ ਵਿੱਚ ਕਾਰੋਬਾਰ ਆਪਣੇ ਯਤਨਾ 'ਤੇ ਧਿਆਨ ਕੇਂਦਰਿਤ ਕਰ ਰਹੇ ਹਨ ਉੱਨਤ ਵਿਸ਼ੇਸ਼ਣ ਅਤੇ ਵਪਾਰਕ ਖੁਫ਼ੀਆ ਸਾਧਨਾਂ ਦਾ ਲਾਭ ਉਠਾ ਕੇ ਕੰਪਨੀਆਂ ਖਪਤਕਾਰਾਂ ਦੇ ਵਿਹਾਰ ਮਾਰਕੀਟ ਰੁਝਾਨਾਂ ਅਤੇ ਸੰਚਾਲਨ ਕਾਰਜ ਕੁਸ਼ਲਤਾ ਵਿੱਚ ਕੀਮਤੀ ਸਮਝ ਪ੍ਰਾਪਤ ਕਰ ਰਹੀਆਂ ਹਨ ਇਹ ਡੇਟਾ ਸੰਚਾਲਿਤ ਪਹੁੰਚ ਕਾਰੋਬਾਰਾਂ ਨੂੰ ਸੂਚਿਤ ਫੈਸਲੇ ਲੈਣ ਉਹਨਾਂ ਦੀਆਂ ਰਣਨੀਤੀਆਂ ਨੂੰ ਅਨੁਕੂਲ ਬਣਾਉਣ ਅਤੇ ਵਿਕਾਸ ਦੇ ਨਵੇਂ ਮੌਕਿਆਂ ਦੀ ਪਹਿਚਾਣ ਕਰਨ ਦੇ ਯੋਗ ਬਣਾਉਂਦਾ ਹੈ ਉਦਾਹਰਣ ਲਈ ਪ੍ਰਚੂਨ ਕਾਰੋਬਾਰ ਵਸਤੂਆਂ ਨੂੰ ਬਥੇਰੇ ਪਵਰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਵਾਨਿਤ ਕਰਨ ਖ਼ਾਸ ਗਾਹਕ ਹਿੱਸੇ ਵਿੱਚ ਮਾਰਕੀਟਿੰਗ ਮੁਹਿੰਮਾਂ ਨੂੰ ਅਨੁਕੂਲ ਅਨੁਕੂਲਿਤ ਕਰਨ ਅਤੇ ਗਾਹਕ ਅਨੁਭਵਾਂ ਨੂੰ ਬਿਹਤਰ ਬਣਾਉਣ ਲਈ ਡੈਟਾ ਵਿਸ਼ੇਸ਼ਣ ਦੀ ਵਰਤੋਂ ਕਰ ਰਹੇ ਹਨ ਇਨ੍ਹਾਂ ਤਰੱਕੀਆਂ ਦੇ ਬਾਵਜੂਦ ਪੰਜਾਬ ਵਿੱਚ ਕਾਰੋਬਾਰਾਂ ਨੂੰ ਅਜੇ ਵੀ ਪੂੰਜੀ ਤੱਕ ਸੀਮਤ ਪਹੁੰਚ ਬੁਨਿਆਦੀ ਢਾਂਚੇ ਦੀਆਂ ਰੁਕਾਵਟਾਂ ਅਤੇ ਰੈਗੂਲੇਟਰੀ ਰੁਕਾਵਟਾਂ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹਨਾਂ ਮੁੱਦਿਆਂ ਨੂੰ ਹੱਲ ਕਰਨ ਲਈ ਕਾਰੋਬਾਰ ਸਰਕਾਰੀ ਪਹਿਲ ਕਦਮੀਆਂ ਤੋਂ ਸਮਰਥਨ ਦੀ ਮੰਗ ਕਰ ਰਹੇ ਹਨ ਜਨਤਕ ਨਿੱਜੀ ਭਾਈਵਾਲੀ ਦਾ ਲਾਭ ਉਠਾ ਰਹੇ ਹਨ ਅਤੇ ਨਵੀਨਤਕਾਰੀ ਵਿੱਤ ਵਿਕਲਪਾਂ ਦੀ ਖੋਜ ਕਰ ਰਹੇ ਹਨ ਰਾਜ ਸਰਕਾਰ ਨੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਅਤੇ ਛੋਟੇ ਅਤੇ ਮੱਧਮ ਆਕਾਰ ਦੇ ਉਦਯੋਗਾਂ ਨੂੰ ਸਮਰਥਨ ਦੇਣ ਲਈ ਕਈ ਸਕੀਮਾਂ ਅਤੇ ਪ੍ਰੋਤਸਾਹਨ ਪੇਸ਼ ਕੀਤੇ ਹਨ ਉਹਨਾਂ ਨੂੰ ਵਿੱਤੀ ਰੁਕਾਵਟਾਂ ਨੂੰ ਦੂਰ ਕਰਨ ਅਤੇ ਲੋੜ ਦੇ ਸਰੋਤਾਂ ਤੱਕ ਪਹੁੰਚ ਕਰਨ ਵਿੱਚ ਮਦਦ ਕਰਦੇ ਹਨ